ਮੈਂ ਆਪਣੇ ਕੈਮਰੇ ਤੋਂ ਫੁੱਲਾਂ ਦੀ ਤਸਵੀਰ ਮੈਕਸੀਮਮ ਖਿੱਚਦੀ ਹਾਂ ਔਰ ਕੋਈ ਨੈਚੁਰਲ ਚੀਜ਼ ਹੋਵੇ ਜਿਵੇਂ ਕਿ ਪੰਛੀ ਕੋਈ ਬਟਰਫਲਾਈ ਮੈਂ ਮੈਕਸੀਮਮ ਇਹਨਾਂ ਦੀ ਹੀ ਤਸਵੀਰਾਂ ਖਿੱਚਦੀ ਹਾਂ ਕਿਉਂਕਿ ਮੈਨੂੰ ਆਪਣੇ ਨੇਚਰ ਨਾਲ ਬਹੁਤ ਹੀ ਜ਼ਿਆਦਾ ਪਿਆਰ ਹੈ ਅਤੇ ਮੈਂ ਉਸ ਨੂੰ ਖਿੱਚ ਕੇ ਆਪਣੀ ਮੋਬਾਇਲ ਵਿੱਚ ਰੱਖਣਾ ਚਾਹੁੰਦੀ ਹਾਂ ਤਾਂ ਕਿ ਜਿਸ ਵੇਲੇ ਮੇਰਾ ਮਨ ਕਰੇ ਮੈਂ ਉਹਨਾਂ ਨੂੰ ਦੇਖ ਸਕਾਂ ਧੰਨਵਾਦ